ਅੱਜ ਦੇ ਟਾਈਮ ਵਿੱਚ ਵੱਡੀਆਂ ਯੂਨੀਵਰਸਿਟੀਜ਼ ਅਤੇ ਕੋਲਜਾਂ ਵਿੱਚ ਮੇਲ ਔਰ ਫੀਮੇਲਜ਼ ਲਈ ਬਰਾਬਰ ਦੇ ਮੌਕੇ ਹੈ ਮੌਕੇ ਹੈਗੇ ਆ ਇਹ ਇਹਦੇ 'ਚ ਕੋਈ ਦੋ ਰਾਹ ਨਹੀਂ ਹੈਗਾ ਹਾਂ ਬਟ ਅੱਜ ਤੋਂ ਕੁਛ ਟਾਈਮ ਪਹਿਲਾਂ ਔਰਤਾਂ ਨੂੰ ਪ੍ਰੋਪਰ ਮੌਕੇ ਨਹੀਂ ਸੀ ਦਿੱਤੇ ਜਾਂਦੇ ਬਟ ਅੱਜ ਦੇ ਟਾਈਮ ਵਿੱਚ ਵੱਡੀਆਂ ਯੂਨੀਵਰਸਿਟੀ ਕੋਲਜਿਸ ਵਿੱਚ ਤਾਂ ਔਰਤਾਂ ਲਈ ਤਾਂ ਵੱਖਰੇ ਤੌਰ 'ਤੇ ਸਪੋਰਟਸ ਔਰ ਇਹ ਸਪੋਰਟਸ ਐਕਟੀਵਿਟੀਜ ਅਤੇ ਸੱਭਿਆਚਾਰਕ ਜਾਂ ਜਾਂ ਕੋਈ ਸੋਸ਼ਲ ਐਕਟੀਵਿਟੀਜ਼ ਹੋਵੇ ਭਾਵੇਂ ਸਟੱਡੀ ਹੋਵੇ ਉਹਨਾਂ ਵਿੱਚ ਔਰਤਾਂ ਔਰਤਾਂ ਲਈ ਤਾਂ ਰੈਜਰਵੇਸ਼ਨਸ ਹੈਗੀਆਂ ਨੇ ਆਪਾਂ ਇਸ ਇਸ ਗੱਲ ਤੋਂ ਬਿਲਕੁਲ ਵੀ ਨਹੀਂ ਨ ਇਸ ਗੱਲ ਨੂੰ ਬਿਲਕੁਲ ਵੀ ਨਕਾਰ ਨਹੀਂ ਸਕਦੇ ਕਿ ਔਰਤਾਂ ਲਈ ਪ੍ਰੋਪਰ ਜਾਂ ਮੇਲਜ਼ ਦੇ ਮੁਕਾਬਲੇ ਆਪੋਚੁਨਿਟੀਜ਼ ਘੱਟ ਨੇ ਪ੍ਰੋਪਰ ਦੋਵਾਂ ਲਈ ਬਰਾਬਰ ਨੇ ਮੌਕੇ ਅਕੋਡਿੰਗ ਟੂ ਮੀ ਤਾਂ